ਸਕੂਲਾਂ ਵਿੱਚ ਬੱਚਿਆਂ ਨੂੰ ਕਈ ਤਰ੍ਹਾਂ ਦੀਆਂ ਵਧੀਆ ਵਧੀਆ ਤਰੀਕੇ ਨਾਲ਼ ਸ਼ਿਲਪਕਾਰੀ ਅਤੇ ਕਲਾ ਸਿਖਾਈ ਜਾਂਦੀ ਹੈ ਜਿਹਨਾਂ ਨਾਲ਼ ਉਨ੍ਹਾਂ ਦਾ ਬਹੁਤ ਜ਼ਿਆਦੇ ਅਨੁਭਵ ਉਹਦੇ ਵਿੱਚ ਇੰਟਰਸਟ ਹੈ ਜਿਹੜਾ ਉਹ ਵੱਧਦਾ ਹੈਗਾ ਆ ਅਤੇ ਬੱਚੇ ਇਹਦੇ ਵਿੱਚ ਬਹੁਤ ਜ਼ਿਆਦੇ ਵਧੀਆ ਤਰੀਕੇ ਨਾਲ਼ ਰਿਜ਼ਲਟ ਲੈ ਕੇ ਆਉਂਦੇ ਨੇ ਅਤੇ ਸਕੂਲਾਂ ਵਿੱਚ ਬੱਚਿਆਂ ਨੂੰ ਇੱਕ ਇਹਨਾਂ ਦਾ ਲੈਗਲ ਜਿਹੜਾ ਕਿ ਲੈਕਚ ਲੈਕਚਰ ਲਾਇਆ ਜਾਂਦਾ ਹੈ ਉਹਨਾਂ ਨੂੰ ਉਹ ਸਿਖਾਉਣ ਲਈ ਉਸ ਚੀਜ਼ ਵੱਲ ਉਹਨਾਂ ਦਾ ਧਿਆਨ ਲਾਉਣ ਲਈ ਕਿ ਉਹ ਅੱਗੇ ਜਾ ਕੇ ਹੋਰ ਵੀ ਇਸ ਤੋਂ ਵਧੀਆ ਕਰ ਸਕਣ ਅਤੇ ਜੇਕਰ ਯ ਮੇਰੀ ਬਚਪਨ ਦੀ ਕੋਈ ਯਾਦ ਜਿੱਦਾਂ ਕਿ ਮੈਂ ਬਣਾਈ ਹੋਵੇ ਉਹਦੀ ਗੱਲ ਕੀਤੀ ਜਾਵੇ ਤਾਂ ਮੇਰੇ ਕੋਲ਼ ਇੱਕ ਗੁੱਡੀ ਪਈ ਆ ਜਿਹੜੀ ਕਿ ਮੈਂ ਛੋਟੇ ਹੁੰਦੇ ਬਚਪਨ ਵਿੱਚ ਬਣਾਈ ਸੀਗੀ ਅਤੇ ਆਪਣੇ ਮੈਂ ਮਾਤਾ ਜੀ ਨਾਲ਼ ਬਣਾਈ ਸੀਗੀ ਉਹ ਬਹਿ ਕੇ ਅਤੇ ਉਹਨਾਂ ਨੇ ਮੈਨੂੰ ਦੱਸਿਆ ਅਤੇ ਮੈਂ ਉਸ ਪ੍ਰਕਾਰ ਨਾਲ਼ ਬਣਾਈ ਅਤੇ ਸਕੂਲ ਵਿੱਚ ਵੀ ਕਈ ਤਰ੍ਹਾਂ ਦੇ ਮੈਂ ਜਿਹੜੇ ਕਿ ਆਰਟ ਐਂਡ ਕ੍ਰਾਫਟ ਕਹਿ ਲਉ ਜਾਂ ਫਿਰ ਕਲਾ ਕੋਈ ਵੀ ਇੱਦਾਂ ਦੀਆਂ ਬਹੁਤ ਜ਼ਿਆਦੇ ਕਲਾ ਕੀਤੀਆਂ ਹਨ ਅਤੇ ਉਹਦੇ ਵਿੱਚ ਮੈਨੂੰ ਕਈ ਪ੍ਰਾਈਜ਼ ਵੀ ਮਿਲੇ ਹਨ ਅਤੇ ਉਹਨਾਂ ਕਲਾ ਨੂੰ ਉਹਨਾਂ ਨੇ ਸੰਭਾਲ਼ ਕੇ ਜਿਹੜਾ ਕਿ ਰੱਖਿਆ ਹੋਇਆ ਹੈ ਜਿਸ ਨਾਲ਼ ਹੋਰ ਬੱਚੇ ਵੀ ਪ੍ਰਭਾਵਿਤ ਹੁੰਦੇ ਹਨ ਅਤੇ ਇਸ ਚੀਜ਼ ਵੱਲ ਧਿਆਨ ਦਿੰਦੇ ਹਨ ਅਤੇ ਇਸ ਚੀਜ਼ ਨੂੰ ਅੱਗੇ ਕਰਦੇ ਨੇ ਅਤੇ ਉਹਨਾਂ ਦਾ ਜਿਹੜਾ ਕਿ ਇੰਟਰਸਟ ਹੈਗਾ ਆ ਉਹ ਇਹਦੇ ਵਿੱਚ ਵੱਧਦਾ ਜਾਂਦਾ ਹੈ